ਹੈਲੋ ਹਾਂਜੀ ਹਾਂਜੀ ਹਾਂਜੀ ਜੀ ਜੀ ਜੀ ਜੀ ਜੀ ਠੀਕ ਹੈ ਜੀ ਤੁਸੀਂ ਤੁਸੀਂ ਹੋਸਟਲ 'ਚ ਰਹਿਣਾ ਜੀ ਇੱਥੇ ਠੀਕ ਹੈ ਜੀ ਹਾਂਜੀ ਹਾਂਜੀ ਦੇਖੋ ਜੀ ਵੈਸੇ ਤਾਂ ਕਲਾਈਮੇਟ ਠੀਕ ਚੱਲ ਰਿਹਾ ਤੁਸੀਂ ਇਸ ਵੀਕ ਦੇ ਵਿੱਚ ਵਿੱਚ ਆਉਣਾ ਇਸ ਮਹੀਨੇ ਆਉਣਾ ਜਾਂ ਜੀ ਅਗਲੇ ਮਹੀਨੇ ਆਉਂਗੇ ਕਿਉਂਕਿ ਕਲਾਸਿਸ ਤਾਂ ਜੀ ਇਸੇ ਵੀਕ ਤੋਂ ਸਟਾਰਟ ਨੇ ਤਾਂ ਮੈਨੂੰ ਲੱਗਦਾ ਤੁਸੀਂ ਇਹੀ ਵੀਕ ਦੇ ਵਿੱਚੇ ਕੋਲਜ 'ਚ ਜੇ ਆ ਜਾਓ ਰੂਮ ਐਲੋਕੇਟ ਹੋ ਜਾਵੇ ਤਾਂ ਤੁਹਾਨੂੰ ਵਧੀਆ ਹਾਂ ਇ ਇਸ ਟਾਈਮ ਦਾ ਇਹ ਤਾਂ ਕਲਾਈਮੇਟ ਠੀਕ ਹੈ ਜੀ ਥੋੜ੍ਹਾ ਜਿਹਾ ਜਿਵੇਂ ਸਰਦੀ ਸਟਾਰਟ ਹੋ ਗਈ ਆ ਅਤੇ ਉਹ ਥੋੜ੍ਹਾ ਜਿਹਾ ਧੁੰਦਲਾ ਮੌਸਮ ਹੈ ਜੀ ਉਹ ਵੀ ਆਪਣੇ ਹੁਣ ਹਾ ਕੱਟੀ ਜਾ ਰਹੀ ਹੈ ਜੀ ਫਸਲ ਫਿਰ ਅੱਗ ਕਰਕੇ ਧੂੰਏ ਕਰਕੇ ਥੋੜ੍ਹਾ ਜਿਹਾ ਧੁੰਦ ਜੀ ਤੇ ਤਰ੍ਹਾਂ ਮੌਸਮ ਹੋਇਆ ਹੋਇਆ ਪਰ ਤੁਸੀਂ ਜੇ ਆਪਣੇ ਸਰਦੀਆਂ ਦੇ ਕੱਪੜੇ ਲੈ ਕੇ ਆਓ ਆਪਣੀ ਰਜ਼ਾਈ ਬਲੈਂਕਡ ਵਗੈਰਾ ਉਹ ਵੀ ਉਹ ਜ਼ਿਆਦਾ ਵਧੀਆ ਜੀ ਅਤੇ ਆਪਣੇ ਕੱਪੜੇ ਵੀ ਸਰਦੀਆਂ ਲਈ ਹੀ ਲੈ ਕੇ ਆਇਓ ਕਿਉਂਕਿ ਪਤਾ ਨਹੀਂ ਲੱਗਦਾ ਰਾਤ ਨੂੰ ਠੰਡ ਹੋ ਜਾਂਦੀ ਹੈ ਅਤੇ ਦਿਨੇ ਗਰਮੀ ਰਹਿੰਦੀ ਹੈ ਧੂੰਏਂ ਕਰਕੇ ਥੋੜ੍ਹੇ ਜਿਹੇ ਗਰਮ ਮੌਸਮ ਰਹਿੰਦਾ ਪਰ ਰਾਤ ਨੂੰ ਪੂਰੀ ਐਨ ਠੰਡ ਹੋ ਜਾਂਦੀ ਹੈ ਜੀ ਇੱਥੇ ਮੈਮ ਹੈਗਾ ਤਾਂ ਬਹੁਤ ਕੁਛ ਹੈ ਜੀ ਦੇਖਣ ਵਾਸਤੇ ਅਤੇ ਗੁਰਦੁਆਰਾ ਸਾਹਿਬ ਨੇ ਦੀ ਜਗ੍ਹਾ ਬਣੀ ਹੋਈ ਹੈ ਅਤੇ ਜੇ ਤੁਸੀਂ ਨੇ ਬਾਹਰ ਵੀ ਪੀਜੀ ਲੈ ਕੇ ਰਹਿਣਾ ਤੁਸੀਂ ਉੱਥੇ ਵੀ ਰਹਿ ਸਕਦੇ ਹੋ ਮੈਨੂੰ ਲੱਗਦਾ ਜੀ ਜਿਹੜੇ ਸਿੱਖ ਬੱਚੇ ਨੇ ਗੁਰਦੁਆਰਾ ਸਾਹਿਬ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਵਿੱਚ ਵੀ ਰੂਮ ਮਿਲਦੇ ਨੇ ਉਹਨਾਂ ਲਈ ਰੂਮ ਅਵੇਲੇਬਲ ਹੈਗੇ ਨੇ ਅਤੇ ਉੱਥੇ ਵੀ ਮੈਨੂੰ ਲੱਗਦਾ ਜੀ ਤੁਹਾਨੂੰ ਆਪਣੇ ਜਿਹੜੀ ਰਜਾਈ ਵਗੈਰਾ ਚਾਦਰ ਵਗੈਰਾ ਏ ਮੌਸਮ ਦੇ ਅਕੋਡਿੰਗ ਤੁਹਾਨੂੰ ਲੈ ਕੇ ਆਉਣੀ ਪੈਣੀ ਆ ਜੀ ਅਤੇ ਉਹ ਸਿਰਫ ਇੱਕ ਤੁਹਾਨੂੰ ਰੂਮ ਪ੍ਰੋਵਾਈਡ ਕਰ ਦਿੰਦੇ ਨੇ ਬਟ ਜਿਹੜਾ ਸਮਾਨ ਹੁੰਦਾ ਏ ਉਹ ਤੁਸੀਂ ਆਪਣਾ ਹੀ ਲੈ ਕੇ ਆਉਣਾ ਪੈਂਦਾ ਏ ਅਤੇ ਇਸ ਟਾਈਮ ਜੇ ਮੈਂ ਤੁਹਾਨੂੰ ਕਹਾਂ ਮੌਸਮ ਦੇ ਆਪਾਂ ਨਰਮ ਦੇ ਨਾਲ ਜਦੋਂ ਦੇਖਦੇ ਹੋਏ ਵੀ ਤੁਸੀਂ ਰਜਾਈ ਵਗੈਰਾ ਆਪਣੀ ਬਲੈਂਕਡ ਹੋ ਗਿਆ ਜੀ ਇਹ ਲੈ ਕੇ ਜ਼ਰੂਰ ਆਇਓ ਅਤੇ ਆਪਣੇ ਕਿਉਂਕਿ ਪਤਾ ਨਹੀਂ ਲੱਗਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੌਸਮ ਦਾ ਪਤਾ ਨਹੀਂ ਲੱਗਦਾ ਸਵੇਰੇ ਤਾਂ ਥੋੜ੍ਹਾ ਠੀਕ ਸਰਦੀ ਹੁੰਦੀ ਇੰਨੀ ਠੰਡ ਨਹੀਂ ਹੁੰਦੀ ਅੱਗ ਲਾ ਅੱਗ ਲਾ ਰਹੇ ਨੇ ਜੀ ਆਪਣੇ ਫਸਲਾਂ ਨੂੰ ਸ ਸਾਰੇ ਹੁਣ ਕਟਾਈ ਵਢਾਈ ਹੋ ਰਹੀ ਆ ਅਤੇ ਰਾਤ ਨੂੰ ਬਹੁਤ ਠੰਡ ਹੋ ਜਾਂਦੀ ਹੈ ਜੀ ਉਦੋਂ ਫਿਰ ਰਜਾਈ ਵਗੈਰਾ ਤੁਹਾਡੀ ਬਲੈਂਕਡ ਯੂਜ ਹੋਵੇਗਾ ਅਤੇ ਤੁਸੀਂ ਨੋਰਮਲ ਕੱਪੜੇ ਲਿਆ ਸਕਦੇ ਹੋ ਕਿ ਜਿਹਦੇ ਵਿੱਚ ਨਾ ਹੀ ਤੁਹਾਨੂੰ ਸਰਦੀ ਆਵੇ ਨਾ ਗਰਮੀ ਆਵੇ ਨੋਰਮਲ ਕੱਪੜੇ ਆਪਣੇ ਲੈ ਕੇ ਆ ਸਕਦੇ ਹੋ ਤੁਸੀਂ ਹਾਂਜੀ ਅਤੇ ਸਪੋਰਟਸ ਲਈ ਤੁਸੀਂ ਆਪਣੇ ਮਾਰਕੀਟ ਵੀ ਹਾਂਜੀ ਮਾਰਕੀਟ ਮਾਰਕੀਟ ਨੇੜੇ ਆ ਜੀ ਤੁਸੀਂ ਜੇ ਤੁਹਾਤੋਂ ਕੋਈ ਚੀਜ਼ ਛੁੱਟ ਵੀ ਗਈ ਤੁਸੀਂ ਇਜੀਲੀ ਇੱਥੋਂ ਤੁਹਾਨੂੰ ਪ੍ਰੋਵਾਈਡ ਹੋ ਸਕਦੀ ਹੈ ਜੀ ਅਤੇ ਜਿਵੇਂ ਆਪਣੇ ਸਭ ਤਰ੍ਹਾਂ ਦੇ ਤੁਹਾਨੂੰ ਆਪਣੇ ਜਿੰਨੇ ਵੀ ਚੀਜ਼ਾਂ ਚਾਹੀਦੀਆਂ ਨੇ ਆਪਣੇ ਰੁਟੀਨ ਦੀਆਂ ਚੀਜ਼ਾਂ ਨੇ ਸਭ ਅਵੇਲੇਬਲ ਹੈਗਾ ਬਟ ਹਾਲੇ ਮੈਂ ਕਹਾਂਗੀ ਕਿ ਤੁਸੀਂ ਆਪਣੇ ਰੂਟੀਨ ਦੇ ਅਕੋਡਿੰਗ ਆਪਣੀ ਲੋੜ ਦੇ ਅਕੋਡਿੰਗ ਆਪਣਾ ਸਮਾਨ ਲੈ ਕੇ ਹੀ ਆਓ ਤਾਂ ਜ਼ਿਆਦਾ ਵਧੀਆ ਹਾਂਜੀ ਠੀ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ